ਹਾਂਜੀ ਬਡਸ ਇੱਕ ਆਜ਼ਾਦ ਪੰਛੀ ਹੈ ਸਾਨੂੰ ਨਹੀਂ ਲੱਗਦਾ ਵੀ ਉਹਨੂੰ ਇੱਦਾਂ ਪਿੰਜਰੇ ਵਿੱਚ ਜਿੱਦਾਂ ਲੋਕ ਘਰ ਵਿੱਚ ਬੰਦ ਕਰਕੇ ਰੱਖਦੇ ਨੇ ਵੀ ਇੱਦਾਂ ਰੱਖਣਾ ਚਾਹੀਦਾ ਵਾ ਉਹ ਇੱਕ ਪਰਮਾਤਮਾ ਨੇ ਆਜ਼ਾਦ ਜੀਵ ਬਣਾਇਆ ਵਾ ਜਦੋਂ ਆਪਾਂ ਉਹਨੂੰ ਬਾਹਰ ਦਰੱਖ਼ਤ 'ਤੇ ਬੈਠੇ ਨੂੰ ਅਸੀਂ ਦੂਰਬੀਨ ਨਾਲ ਦੇਖਦੇ ਹਾਂ ਤਾਂ ਉਹ ਕਿੰਨਾ ਆਪਣਾ ਚਹਿਕ ਮਹਿਕ ਕਰਦਾ ਕਿੰਨੀ ਖੁਸ਼ੀ ਮਹਿਸੂਸ ਕਰਦਾ ਵਾ ਆਪਣੇ ਪੰਖਾਂ ਨੂੰ ਖਿਲਾਉਂਦਾ ਵਾ ਕਦੇ ਇਕੱਠੇ ਕਰਦਾ ਉਹ ਆਪਾਂ ਨੂੰ ਕਿੰਨਾ ਪਿਆਰਾ ਲੱਗਦਾ ਵਾ ਅਤੇ ਉਹ ਵੀ ਆਪਣੀ ਜ਼ਿੰਦਗੀ ਵਧੀਆ ਜਿਉਂਦਾ ਵਾ ਪਰ ਸਾਨੂੰ ਤਾਂ ਸਾਡੀ ਤਾਂ ਸੋਚਣੀ ਇਹ ਆ ਵੀ ਉਹਨੂੰ ਘਰ ਵਿੱਚ ਕੈਦ ਕਰਕੇ ਨਹੀਂ ਰੱਖਣਾ ਚਾਹੀਦਾ ਵਾ ਸਾਨੂੰ ਨਹੀਂ ਪਤਾ ਲੱਗਦਾ ਵੀ ਉਹਨੂੰ ਕਈ ਕ ਖਾਣੇ ਸਮੇਂ ਕੀ ਦੇਣਾ ਚਾਹੀਦਾ ਕੀ ਨਹੀਂ ਕਿਉਂਕਿ ਉੱਥੇ ਉਹਦਾ ਜਦੋਂ ਬਾਹਰ ਉਹਦਾ ਦਿਲ ਕਰਦਾ ਉਹ ਜਦੋਂ ਜਿਹੜੀ ਚੀਜ਼ ਨੂੰ ਦਿਲ ਕਰਦਾ ਆਪਣਾ ਖਾਂਦਾ ਪੀਂਦਾ ਅਸੀਂ ਤਾਂ ਘਰ ਵਿੱਚ ਦੂਰਬੀਨ ਰੱਖੀ ਹੋਈ ਆ ਅਸੀਂ ਉਹਨੂੰ ਦੂਰਬੀਨ ਨਾਲ ਦੇਖ ਕੇ ਹੀ ਉਹਦਾ ਆਨੰਦ ਮਾਣਦੇ ਹਾਂ ਸਾਨੂੰ ਤਾਂ ਇੱਦਾਂ ਹੀ ਵਧੀਆ ਲੱਗਦਾ ਵਾ ਵੀ ਸਵੇਰੇ ਸ਼ਾਮ ਉਹਨੂੰ ਬਾਹਰ ਹੀ ਦੇਖੋ ਤਾਂ ਉਹਦਾ ਆਨੰਦ ਲਵੋ ਅਤੇ ਉਹਨੂੰ ਵੀ ਆਨੰਦ ਨਾਲ ਜਿਉਣ ਦਿਓ